ਅਸੀਂ ਗਾਉਣ ਦਾ ਜਿਹੜਾ ਪ੍ਰਦਰਸ਼ਨ ਕਰਦੇ ਹਨ ਉਹ ਚੜ੍ਹਦੀ ਕਲਾ ਦੇ ਵਿੱਚ ਕਰਦੇ ਹਾਂ ਕਿ ਲੋਕਾਂ ਨੂੰ ਕਿ ਜੋਸ਼ ਆਵੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਗਾਉਂਦੇ ਹਾਂ ਅਤੇ ਬਾਕੀ ਜਿਹੜਾ ਮਤਲਬ ਗਾਉਣ ਦੇ ਵਿੱਚ ਅਸੀਂ ਚੀਜ਼ਾਂ ਦਾ ਪਰਹੇਜ਼ ਰੱਖਦੇ ਹਾਂ ਠੰਡਾ ਪਾਣੀ ਖੱਟਾ ਅਤੇ ਹੋਰ ਤਲ਼ੀਆਂ ਹੋਈਆਂ ਚੀਜ਼ਾਂ ਹੋ ਗਈਆਂ ਗਰਮ ਪਾਣੀ ਅਤੇ ਇਹ ਚੀਜ਼ਾਂ ਦਾ ਮਤਲਬ ਜਿਹੜਾ ਸੇਵਨ ਹੈ ਠੰਡਾ ਪਾਣੀ ਹੋ ਗਿਆ ਅਤੇ ਖੱਟੀਆਂ ਚੀਜ਼ਾਂ ਹੋ ਗਈਆਂ ਅਤੇ ਤਲੀਆਂ ਵੀਆਂ ਚੀਜ਼ਾਂ ਹੋ ਗਈਆਂ ਇਨ੍ਹਾਂ ਇਹ ਨਹੀਂ ਵਰਤੋਂ ਕਰਨੀਆਂ ਚਾਹੀਦੀਆਂ ਕਿਉਂਕਿ ਗਾਉਣ ਦੇ ਵਿੱਚ ਇਹਦੇ ਨਾਲ ਸਾਡਾ ਗਲਾ ਬੈਠ ਜਾਂਦਾ ਹੈ ਅਤੇ ਇਹਦੇ 'ਚ ਗਰਮ ਪਾਣੀ ਦੀ ਅਤੇ ਜਿਹੜਾ ਗਰਮ ਪਾਣੀ ਹੈ ਉਹ ਪੀਣਾ ਚਾਹੀਦਾ ਉਹਦੇ ਨਾਲ ਗਲ਼ਾ ਸਾਡਾ ਸਾਫ ਹੋ ਜਾਂਦਾ